ਨਰਿੰਦਰ ਕਪੂਰ ਜੀ ਦੀ ਬੁੱਕ ਹੈ ਖਿੜਕੀਆਂ ਜਿਸ ਵਿੱਚ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਲੈ ਕੇ ਆਪਣੇ ਵਿਊਜ਼ ਸ਼ੇਅਰ ਕੀਤੇ ਹੋਏ ਨੇ ਜਿਹੜਾ ਇੱਕ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਇੱਕ ਲੜਕੀ ਜੋ ਸ਼ਾਇਦ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹਨੇ ਕੁਛ ਖਾਸ ਕੱਪੜੇ ਨਹੀਂ ਪਾਏ ਹੁੰਦੇ ਉਹ ਬੱਸ ਦੇ ਵਿੱਚ ਚੜ੍ਹਦੀ ਹੈ ਬੱਸ ਦੇ ਵਿੱਚ ਸਾਰੇ ਅਮੀਰ ਲੋਕ ਬੈਠੇ ਹੁੰਦੇ ਹੈ ਲੜਕੀ ਦੇ ਬੈਠਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਣ ਲੱਗ ਜਾਂਦੀ ਹੈ ਅਤੇ ਸਾਰੇ ਬੱਸ ਵਾਲੇ ਲੋਕ ਕਹਿਣ ਲੱਗ ਜਾਂਦੇ ਕਿ ਤੂੰ ਮਨਹੂਸ ਹੈ ਤੇਰੇ ਕਰਕੇ ਬਾਰਿਸ਼ ਹੋਣੀ ਸ਼ੁਰੂ ਹੋਈ ਹੈ ਉਹ ਦ ਥੋੜ੍ਹਾ ਅੱਗੇ ਜਾ ਕੇ ਉਸ ਲੜਕੀ ਨੂੰ ਬੱਸ ਵਿੱਚੋਂ ਉਤਾਰ ਦਿੰਦੇ ਹੈ ਅਤੇ ਉਹ ਬੱਸ ਥੋੜ੍ਹਾ ਹੋਰ ਅੱਗੇ ਜਾਂਦੀ ਹੈ ਅਤੇ ਇੱਕ ਖਾਈ ਵਿੱਚ ਡਿੱਗ ਜਾਂਦੀ ਹੈ ਅਤੇ ਇਸ ਘਟਨਾ ਤੋਂ ਅਸੀਂ ਇਹ ਆਈਡੀਆ ਲਗਾ ਸਕਦੇ ਹਾਂ ਕਿ ਕੌਣ ਖੁਸ਼ਕਿ ਖੁਸ਼ਕਿਸਮਤ ਸੀ ਔਰ ਕੌਣ ਮਨਹੂਸ ਸੀਗਾ ਇਹ ਨਰਿੰਦਰ ਕਪੂਰ ਜੀ ਨੇ ਆਪਣੀ ਜਿਹੜੀ ਬੁੱਕ ਹੈ ਖਿੜਕੀਆਂ ਵਿੱਚ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੋਇਆ